ਸਮਾਰਟ ਵਾ ਵਾਚ ਦੇ ਬੜੇ ਹੀ ਫਾਇਦੇ ਆ ਜੀ ਸਵੇਰੇ ਮੇਰਾ ਬੇਟਾ ਔਰ ਮੈਂ ਅਸੀਂ ਸੈਰ ਨੂੰ ਜਾਂਦੇ ਹਾਂ ਜੀ ਜਿਹਦੇ ਵਿੱਚੋਂ ਮੇਰੇ ਬੇਟੇ ਨੇ ਮੈਨੂੰ ਸ ਸਮਾਰਟ ਵਾਚ ਲਿਆ ਕੇ ਦਿੱਤੀ ਦੀ ਹੈ ਜਿਸ 'ਚ ਉਹਦੇ ਬਹੁਤ ਜ਼ਿਆਦਾ ਫਾਇਦੇ ਨੇ ਅਤੇ ਜਿਸ 'ਚੋਂ ਜ਼ਿਆਦਾ ਤੇਜ਼ ਚੱਲਣ ਲਈ ਪਤਾ ਲੱਗ ਜਾਂਦਾ ਵੀ ਬੀ ਪੀ ਦੀ ਸ਼ਿਕਾਇਤ ਜਾਂ ਹਾਰਟਵੀਟ ਜਾਂ ਕੋਈ ਟੈਂਪਰੇਚਰ ਕਿੰਨਾ ਕਿੰਨਾ ਨਹੀਂ ਹੈ ਇਹਦੇ ਬਹੁਤ ਹੀ ਫਾਇਦਾ ਇਹਦਾ ਕੋਈ ਨੁਕਸਾਨ ਨਹੀਂ ਹੈ ਜੀ ਇਹ ਜਿੰਨੀਆਂ ਵੀ ਚੀਜ਼ਾਂ ਸਾਡੇ ਫਾਇਦੇ ਲਈ ਹੈਗੀਆਂ ਜਿਹਦੇ ਵਿੱਚੋਂ ਇਹ ਬਹੁਤ ਹੀ ਫਾਇਦਾ ਹੀ ਫਾਇਦਾ ਜੀ ਕਿੰਨੇ ਕਦਮ ਚੱਲੇ ਹਾਂ ਕਿੰਨਾ ਚੱਲੇ ਹਾਂ ਕਿੰਨੀ ਸੈਰ ਕੀਤੀ ਹੈ ਇਹਦਾ ਸਾਰਾ ਰਿਜ਼ਲਟ ਸਾਨੂੰ ਪਤਾ ਲੱਗ ਜਾਂਦਾ ਹੈ ਇਸ 'ਚ ਜਿਵੇਂ ਕਿ ਜੀ ਪੀ ਐਸ ਦੀਆਂ ਘੜੀਆਂ ਚੱਲ ਰਹੀਆਂ ਬਹੁਤ ਹੀ ਵਧੀਆ ਚੱਲ ਰਹੀਆਂ ਜਿਹਦੇ ਬਹੁਤ ਹੀ ਫਾਇਦੇ ਆ